ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਅਤੇ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਲੋਕ ਰਾਜਨੀਤਿਕ ਤਨਾਅ ਪੈਦਾ ਕਰਨ ਲਈ ਧਰਮ ਦਾ ਫਾਇਦਾ ਚੁੱਕਦੇ ਹਨ ਅਤੇ ਧਰਮ ਨੂੰ ਵਪਾਰ ਵਜੋਂ ਵਰਤਦੇ ਹਨ ਕਈ ਸਿੱਖ ਹਿੰਦੂ ਅਤੇ ਮੁਸਲਮਾਨ ਪਾਰਟੀਆਂ ਵੋਟਾਂ ਦੇ ਨੇੜੇ ਆ ਕੇ ਕੁਝ ਇਹੋ ਜਿਹੇ ਕੰਮ ਕਰਦੀਆਂ ਹਨ ਜਿਸ ਕਰਕੇ ਉਹ ਧਰਮਾਂ ਵਿੱਚ ਸਿੱਖ ਹਿੰਦੂ ਅਤੇ ਮੁਸਲਮਾਨ ਲੋਕਾਂ ਵਿੱਚ ਤਨਾਅ ਪੈਦਾ ਕਰ ਸਕਣ ਤਾਂ ਜੋ ਉਹ ਇੱਕ ਦੂਜੇ ਵਿੱਚ ਦੰਗੇ ਕਰਨ ਅਤੇ ਇਸ ਕਰਕੇ ਪਾਰਟੀ ਨੂੰ ਜ਼ਿਆਦਾ ਫਾਇਦਾ ਹੋ ਸਕੇ ਉਹ ਕਿਸੇ ਇੱਕ ਧਰਮ ਦਾ ਫੇਵਰ ਕਰਕੇ ਜ਼ਿਆਦਾ ਵੋਟਾਂ ਦੀ ਤਲਾਸ਼ ਵਿੱਚ ਰਹਿੰਦੇ ਹਨ ਹਰੇਕ ਪਾਰਟੀ ਧਰਮ ਨੂੰ ਵਪਾਰ ਵਜੋਂ ਵਰਤਦੇ ਹਨ ਤਾਂ ਜੋ ਉਹਨਾਂ ਦਾ ਸ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋ ਸਕੇ ਪੈਸੇ ਵਜੋਂ ਅਤੇ ਵੋਟਾਂ ਵਜੋਂ ਵੀ ਧੰਨਵਾਦ